ਤੁਸੀਂ ਜਮੈਟੋ ਕੰਪਨੀ ਵੱਲੋਂ ਬੋਲ ਰਹੇ ਹੋ ਮੈਂ ਕੁਝ ਦਿਨ ਪਹਿਲਾਂ ਤੁਹਾਨੂੰ ਇੱਕ ਮੇਲ ਭੇਜਿਆ ਸੀ ਜਿਸ ਵਿੱਚ ਮੈਂ ਆਪਣਾ ਆਟੋ ਪੇ ਸੈਟਿੰਗ ਨੂੰ ਰੱਦ ਕਰਾਉਣਾ ਸੀ ਕਿਉਂਕਿ ਮੇਰੇ ਕ੍ਰੈਡਿਟ ਕਾਰਡ ਦੀ ਲਿਮਿਟ ਖਤਮ ਹੋ ਚੁੱਕੀ ਸੀ ਜਿਸ ਕਰਕੇ ਇਸ ਵਿੱਚ ਹੁਣ ਪੈਸੇ ਨਹੀਂ ਹਨ ਮੈਂ ਤੁਹਾਨੂੰ ਫੋਨ ਵੀ ਕੀਤਾ ਸੀ ਲਾਈਨ ਬਿਜ਼ੀ ਹੋਣ ਕਰਕੇ ਫੋਨ ਨਹੀਂ ਸੀ ਲੱਗਿਆ ਪਰ ਉਸ ਦਾ ਹੱਲ ਹੁਣ ਮੈਂ ਕਰ ਲਿਆ ਹੈ ਮੈਂ ਤੁਹਾਡੇ ਆ ਐਪ ਦੀ ਸੈਟਿੰਗ ਵਿੱਚ ਜਾ ਕੇ ਪੇਮੈਂਟ ਵਿਕਲਪ ਵਿੱਚੋਂ ਆਟੋ ਪੇ ਨੂੰ ਰੱਦ ਕਰ ਦਿੱਤਾ ਹੈ